ਕੋਈ ਵੀ ਜਦੋਂ ਮੈਂ ਲਿਖਦਾ ਹਾਂ ਵਿਚਾਰ ਲਿਖਦਾ ਹਾਂ ਤਾਂ ਮੇਰੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਹਨ ਸਮਾਜ ਵਿੱਚ ਜੋ ਵੀ ਚੰਗਾ ਮਾੜਾ ਵਰਤਾਵਾ ਵਰਤਦਾ ਹੈ ਮੈਂ ਉਹਨਾਂ ਉਸ ਨੂੰ ਧਿਆਨ ਵਿੱਚ ਲਿ ਰੱਖ ਕੇ ਹੀ ਲਿਖਦਾ ਹਾਂ ਕਿਉਂਕਿ ਮੇਰਾ ਜੋ ਜ਼ਿਆਦਾ ਮੁੱਦਾ ਹੈ ਉਹ ਹੈ ਕੁਦਰਤ ਦੇ ਨਾਲ ਜੋ ਛੇੜਛਾੜ ਹੋ ਰਹੀ ਹੈ ਕੁਦਰਤ ਦੇ ਨਾਲ ਜੋ ਆਪਣਾ ਮਨੁੱਖੀ ਛੇੜਛਾੜ ਹੋ ਰਹੀ ਆ ਉਹਦੇ ਬਾਰੇ ਮੈਂ ਕਵਿਤਾਵਾਂ ਦੇ ਰੂਪ ਵਿੱਚ ਲਿਖਦਾ ਹਾਂ ਸਮਾਜ ਵਿੱਚ ਜੋ ਚੰਗੀਆਂ ਮਾੜੀਆਂ ਜੋ ਪ੍ਰਵਿਰਤੀਆਂ ਪੈਦਾ ਹੋ ਰਹੀਆਂ ਹਨ ਉਹਨਾਂ ਬਾਰੇ ਲਿਖਦਾ ਹਾਂ ਅਤੇ ਸਰਕਾਰ ਕਿੰਨ੍ਹਾਂ ਕਿੰਨ੍ਹਾਂ ਗੱਲਾਂ ਤੋਂ ਜਿਹੜੀ ਹੈਗੀ ਆ ਪਾਸਾ ਵੱਟ ਰਹੀ ਆ ਲੋਕ ਮੁੱਦਿਆਂ ਤੋਂ ਉਹਦੇ ਬਾਰੇ ਲਿਖਣ ਦੀ ਮਨ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਕਿਉਂਕਿ ਜੋ ਸਰਕਾਰਾਂ ਹਨ ਉਹ ਮਤ ਹੁੰਦੀਆਂ ਹੀ ਲੋਕਾਂ ਨੇ ਸਰਕਾਰਾਂ ਨੂੰ ਬਣਾਇਆ ਹੁੰਦਾ ਹੈ ਅਤੇ ਲੋਕਾਂ ਨੇ ਹੀ ਸਰਕਾਰਾਂ ਸਰਕਾਰਾਂ ਨੇ ਲੋਕਾਂ ਦਾ ਕੰਮ ਕਰਨਾ ਹੁੰਦਾ ਹੈ ਇਸ ਕਰਕੇ ਜੋ ਜੋ ਸਮਾਜਿਕ ਮੁੱਦੇ ਹਨ ਉਹ ਉਹ ਪਹਿਲ ਦੇ ਅਧਾਰ 'ਤੇ ਵਾਚ ਕੇ ਮੈਂ ਉਹਨਾਂ ਨੂੰ ਕਵਿਤਾ ਦੇ ਰੂਪ ਵਿ ਦੇ ਵਿੱਚ ਲੇਖਣੀ ਦੇ ਰੂਪ ਦੇ ਵਿੱਚ ਮੈਂ ਲਿਖਦਾ ਹਾਂ ਮੇਰੀਆਂ ਅਕਸਰ ਹੀ ਜੋ ਵਾਤਾਵਰਨ ਬਾਰੇ ਕਵਿਤਾਵਾਂ ਉਹ ਵੱਖ ਵੱਖ ਅਖਬਾਰਾਂ ਵਿੱਚ ਛਪੀਆਂ ਅਤੇ ਉਹਨਾਂ ਨੂੰ ਮਤਲਬ ਕਿ ਚੰਗਾ ਹੁੰਗਾਰਾ ਵੀ ਮਿਲਿਆ ਹੈ